ਖੇਡਾਂ ਦੇ ਖੇਤਰ ਅਤੇ ਵੱਖ ਵੱਖ ਦੌਰ ਦੇ ਸਮਰੱਥ ਜਿਹੜੇ ਖਿਡਾਰੀ ਹੁੰਦੇ ਆ ਉਹਨਾਂ ਦੀ ਮਦਦ ਜਿਹੜੀ ਆ ਉਹ ਪਹਿਲਾਂ ਪਿੰਡਾਂ ਦੇ ਲੈਵਲ ਤੋਂ ਸ਼ੁਰੂ ਹੁੰਦੀ ਆ ਉਹਨਾਂ ਦੇ ਪਿੰਡਾਂ 'ਚ ਬਹੁਤ ਸਹੂਲਤ ਕੀਤ ਉਹਨਾਂ ਨੂੰ ਕੀਤੀ ਦਿੱਤੀ ਜਾਂਦੀਆਂ ਨਾ ਜਿਵੇਂ ਕਿ ਉਹਨਾਂ ਨੂੰ ਪੈਸੇ ਦੀ ਸਹੂਲਤ ਜਿਵੇਂ ਖੇਡਣਗੇ ਉਹਨਾਂ ਨੂੰ ਖੁਰਾਕ ਆਦਿ ਦਾ ਧਿਆਨ ਰੱਖਿਆ ਜਾਂਦਾ ਏ ਜਾਂ ਤਾਂ ਜੋ ਪਿੰਡ ਦੇ ਵਿੱਚੋਂ ਬਾਹਰ ਉਹ ਨੈਸ਼ਨਲ ਲੈਵਲ 'ਤੇ ਇੰਟਰਨੈਸ਼ਨਲ ਲੈਵਲ 'ਤੇ ਜਾ ਸਕਣ ਅਤੇ ਇਸ ਲਈ ਉਹਨਾਂ ਦੀ ਬਹੁਤ ਜਿਹੜੇ ਜਿਹੜੇ ਹੁੰਦੇ ਆ ਵੀ ਖੇਡਣ ਦੇ ਲੈਵਲ ਸਮਰੱਥ ਆ ਜਿਹੜੇ ਖੇਡਣ ਲਈ ਇਹਨਾਂ ਉਹਨਾਂ ਨੂੰ ਚੁਣਿਆ ਜਾਂਦਾ ਇਹਨਾਂ ਟੀਮ ਬਣਾਈ ਜਾਂਦੀ ਆ ਟੀਮ ਦੇ ਵਿੱਚ ਜਿਵੇਂ ਕਿ ਉਹ ਜਿਹੜਾ ਵਧੀਆ ਪ੍ਰਦਰਸ਼ਨ ਕਰਦਾ ਵਾ ਖਿਡਾਰੀ ਖੇਡਦਾ ਵਾ ਉਹਨਾਂ ਨੂੰ ਉਚੇਚੇ ਤੌਰ 'ਤੇ ਇਨਾਮ ਪੈਸੇ ਕੱਪੜੇ ਆਦਿ ਲੈ ਕੇ ਦਿੱਤੇ ਜਾਂਦੇ ਜੋ ਵੀ ਉਹਨਾਂ ਦੀ ਸਹੂਲਤਾਂ ਹੁੰਦੀਆਂ ਉਹਨਾਂ ਦੀ ਮ ਮਦਦ ਕੀਤੀ ਜਾਂਦੀ ਆ ਇਸ ਤਰ੍ਹਾਂ ਕਿ ਉਹ ਉਤਸ਼ਾਹਿਤ ਹੁੰਦੇ ਹਨ ਅਤੇ ਜਿਹੜੀਆਂ ਸਹੂਲਤਾਂ ਵਾ ਉਹਨਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਵਾ ਇਹ ਅਤੇ ਹੋਰ ਜਿਵੇਂ ਕਿ ਖਿਡਾਰੀ ਹੁੰਦੇ ਆ ਉਹਨਾਂ ਦੀ ਆਰਥਿਕ ਤੌਰ 'ਤੇ ਮਦਦ ਹੋ ਜਾਂਦੀ ਹੈ ਜਿਵੇਂ ਕਿ ਉਹ ਫਿਜੀਕਲੀ ਵੀ ਫਿਟ ਰਹਿੰਦੇ ਆ ਓ ਬਿਮਾਰੀਆਂ ਉਹਨਾਂ ਤੋਂ ਦੂਰ ਰਹਿੰਦੀਆਂ ਵਾ ਇਸ ਲਈ ਉਹ ਐਕਟਿਵ ਰਹਿੰਦੇ ਹਮੇਸ਼ਾਂ ਇੰਨਾਂ ਚੁਸਤ ਚੁਸਤੀ ਫੁਰਤੀ ਦੇ ਨਾਲ ਕੰਮ ਕਰਦੇ ਖੇਡਦੇ ਆ